ਹਾਂਜੀ ਮੈਮ ਅੱਛਾ ਜੀ ਗਰੈਜੂਏਸ਼ਨ 'ਚ ਕੀ ਕੀਤਾ ਹੋਇਆ ਜੀ ਠੀਕ ਹੈ ਬੀਕੌਮ ਹੋਰ ਹੋਰ ਨਹੀਂ ਅੱਗੇ ਕੁਛ ਕੀਤਾ ਹੋਇਆ ਜੀ ਠੀਕ ਹੈ ਜੀ ਇਹਦੇ ਵਿੱਚ ਆਪਣੇ ਕਲਰਕ ਦੀਆਂ ਨਿਕਲਦੀਆਂ ਜੀ ਡਾਟਾ ਔਪਰੇਟਰ ਦੀਆਂ ਜੀ ਅਤੇ ਪਟਵਾਰੀ 'ਚ ਆ ਜਾਂਦੀ ਆ ਜੀ ਅਤੇ ਸਟੈਨੋ ਦੀ ਆ ਜਾਂਦੀ ਹੈ ਜੀ ਹਾਂਜੀ ਹਾਂਜੀ ਸਟੈਨੋ ਦਾ ਸਕੋਪ ਹੈਗਾ ਜੀ ਬਹੁਤ ਵਧੀਆ ਜੀ ਤਾਂ ਇਹਦਾ ਮੰਨ ਕੇ ਚੱਲੋ ਵੀ ਤੁਸੀਂ ਤੁਹਾਨੂੰ ਪਹਿਲਾਂ ਬੇਸਿਕ ਬੁੱਕ ਕਰਵਾਈ ਜਾਊਗੀ ਜੀ ਇਹ 'ਚ ਤਿੰਨ ਮਹੀਨਿਆਂ 'ਚ ਤਿੰਨ ਮਹੀਨਿਆਂ 'ਚ ਵੀ ਬੇਸਿਕ ਬੁੱਕ ਹੀ ਕੰਪਲੀਟ ਹੋਊਗੀ ਅਤੇ ਉਸ ਤੋਂ ਬਾਅਦ ਤੁਹਾਨੂੰ ਚਾਰ ਮਹੀਨੇ ਮੰਨ ਕੇ ਚੱਲੋ ਸਪੀਡ ਦੇ ਲੱਗ ਜਾਣਗੇ ਸਪੀਡ ਬਣਾਉਣ 'ਤੇ ਅਤੇ ਜਿਵੇਂ ਆਪਾਂ ਨੂੰ ਮੰਨ ਕੇ ਚੱਲੋ ਪਹਿਲੀ ਕਲਾਸ ਦੇ ਨਰਸਰੀ ਕਲਾਸ 'ਚ ਬੱਚੇ ਨੂੰ ਸਿਖਾਇਆ ਜਾਂਦਾ ਏ ਬੀ ਸੀ ਡੀ ਤਾਂ ਇਸ ਤਰ੍ਹਾਂ ਹੀ ਤੁਹਾਨੂੰ ਸਟੈਨੋ ਤੋਂ ਸਟਾਰਟਿੰਗ ਤੋਂ ਸਿਖਾਈ ਜਾਊਗੀ ਜਮਾਂ ਬਿਲਕੁਲ ਜੀਰੋ ਤੋਂ ਬੇਸਿਕ ਬੁੱਕ ਹੋਣੀ ਲਾਜ਼ਮੀ ਹੈ ਜ਼ਰੂਰੀ ਹੈ ਅਤੇ ਇਹ ਤਿੰਨ ਮਹੀਨਿਆਂ ਦੀ ਬੇਸਿਕ ਬੁੱਕ ਹੁੰਦੀ ਹੈ ਅਤੇ ਉਸ ਤੋਂ ਬਾਅਦ ਸਪੀਡ ਬਣਾਉਣੀ ਪੈਂਦੀ ਹੈ ਫਿਰ ਤੁਹਾਡੀ ਹਾਈ ਕੋਰਟ ਦੇ ਵਿੱਚ ਨਿਕਲਦੀਆਂ ਇਹਨਾਂ ਦੀਆਂ ਪੋਸਟਾਂ ਅਤੇ ਹਰ ਇੱਕ ਹਰ ਇੱਕ ਡਿਪਾਰਟਮੈਂਟ 'ਚ ਹੀ ਹੁੰਦੀ ਆ ਵੈਸੇ ਤਾਂ ਅਤੇ ਜਿਵੇਂ ਹਾਈ ਕੋਰਟ ਦੇ ਵਿੱਚ ਹੋ ਗਿਆ ਅਤੇ ਆਪਣੇ ਕੋਰਟ 'ਚ ਹੋ ਗਿਆ ਹੈ ਨਾ ਸਾਰੇ ਡਿਪਾਰਟਮੈਂਟਾਂ 'ਚ ਨਿਕਲਦੀਆਂ ਹੀ ਰਹਿੰਦੀਆਂ ਇਹਨਾਂ ਦੀਆਂ ਪੋਸਟਾਂ ਅਤੇ ਤੁਸੀਂ ਆਪਣੇ ਕਿਤੇ ਵੀ ਕਰ ਲਿਓ ਆਪਣੇ ਜੇ ਨੇੜੇ ਜਿਲ੍ਹੇ ਕੁਛ ਵੀ ਪੈਂਦਾ ਨਾ ਜੀ ਤਾਂ ਉੱਥੋਂ ਕਿਤੋਂ ਵੀ ਕਰ ਸਕਦੇ ਹੋ ਕੋਈ ਇੱਦਾਂ ਉਹ ਨਹੀਂ ਹੁੰਦਾ ਅਤੇ ਸਕੋਪ ਹੈਗਾ ਇਸ ਚੀਜ਼ ਦਾ ਹਾਂ ਇਹਦੀ ਫੀਸ ਜੀ ਬਸ ਆਹ ਹੀ ਹੁੰਦੀ ਹੈ ਜੀ ਬਾਰਾਂ ਕੁ ਸੌ ਰੁਪਈਆ ਹੁੰਦੀ ਹੈ ਜੀ ਇਹਦੇ 'ਚ ਟਾਈਪਿੰਗ ਵੀ ਹੁੰਦੀ ਆ ਨਾ ਜੀ ਅਤੇ ਇਹਦੀ ਫੀਸ ਤਾਂ ਮੰਨ ਕੇ ਚੱਲੋ ਸਾਢੇ ਕੁ ਸੱਤ ਸੌ ਰੁਪਈਆ ਹੁੰਦੀ ਹੈ ਬਾਕੀ ਫੀਸ ਆਪਣੀ ਹੋ ਜਾਂਦੀ ਹੈ ਟਾਈਪਿੰਗ ਦੀ ਹੋ ਜਾਂਦੀ ਹੈ ਜੀ ਹਾਂਜੀ ਇੰਗਲਿਸ਼ ਪੰਜਾਬੀ ਦੋਨੋਂ ਸਟੈਨੋ ਆ ਜਾਂਦੀ ਹੈ ਜੀ ਫਿਰ ਤੁਹਾਨੂੰ ਦੋਨਾਂ ਦੀ ਤੁਹਾਨੂੰ ਟਾਈਪਿੰਗ ਵੀ ਜ਼ਰੂਰੀ ਹੈ ਜੀ ਹੈਗਾ ਇਹਦਾ ਪਝੱਤਰ ਕੁ ਪਰਸੈਂਟ ਸਕੋਪ ਹੈਗਾ ਪੰਜਾਬ ਦੇ ਵਿੱਚ ਮੰਨ ਕੇ ਚੱਲੋ ਵੀ ਇਕੱਲੀ ਆਪਣੀ ਪੰਜਾਬੀ ਸਟੈਨੋ ਦਾ ਹੈਗਾ ਜੀ ਅਤੇ ਜੇ ਆਪਾਂ ਇੰਡੀਆ ਬੇਸ 'ਤੇ ਵੇਖੀਏ ਤਾਂ ਜੀ ਇੰਗਲਿਸ਼ ਦਾ ਜਿਆਦਾ ਹੈ ਜੀ ਹਾਂਜੀ ਅਤੇ ਹਾਂ ਠੀਕ ਹੈ ਜੀ